ਹਾਂਜੀ ਮੈਂ ਇੱਕ ਅਜਿਹੀ ਕਿਤਾਬ ਪੜ੍ਹੀ ਹੈ ਜਿਸਨੇ ਮੈਨੂੰ ਬੌਧਿਕ ਤੌਰ 'ਤੇ ਚੁਣੌਤੀ ਦਿੱਤੀ ਹੈ ਜਿਸਦਾ ਨਾਮ ਥ੍ਰੀ ਸਿਕਸਟੀ ਫਾਇਵ ਸਾਇੰਸ ਐਂਡ ਟੈਕਨੋਲੋਜੀ ਫੈਕਟਸ ਹੈ ਇਸਨੇ ਮੈਨੂੰ ਬਹੁਤ ਹੀ ਚੁਣੌਤੀਆਂ ਦਿੱਤੀਆਂ ਹਨ ਅਤੇ ਬਹੁਤ ਹੀ ਜਾਣਕਾਰੀ ਵੀ ਦਿੱਤੀ ਹੈ ਅਤੇ ਮੈਂ ਇਸ ਕਿਤਾਬ ਬਾਰੇ ਆਪਣੇ ਪਰਿਵਾਰ ਅਤੇ ਆਪਣੇ ਦੋਸਤਾਂ ਨਾਲ ਵੀ ਕਾਫੀ ਚਰਚਾ ਕਰਦਾ ਹਾਂ ਜਿਸ ਵਿੱਚ ਮੈਂ ਉਹਨਾਂ ਨੂੰ ਜੋ ਮੈਂ ਇਸ ਕਿਤਾਬ ਤੋਂ ਜਾਣਕਾਰੀ ਪ੍ਰਾਪਤ ਕੀਤੀ ਹੈ ਉਹ ਵੀ ਦੱਸਦਾ ਹਾਂ ਅਤੇ ਜੋ ਇਸ ਕਿਤਾਬ ਨੇ ਮੈਨੂੰ ਬੌਧਿਕ ਤੌਰ 'ਤੇ ਚੁਣੌਤੀਆਂ ਦਿੱਤੀਆਂ ਹਨ ਉਸਦੇ ਵੀ ਉੱਤਰ ਪੁੱਛਦਾ ਹਾਂ ਪਰੰਤੂ ਇਹ ਕਿਤਾਬ ਬਹੁਤ ਹੀ ਦਿਲਚਸਪ ਹੈ ਇਸ ਕਿਤਾਬ ਨੂੰ ਪੜ੍ਹਨ ਵਿੱਚ ਮੇਰੀ ਬਹੁਤ ਹੀ ਰੁਚੀ ਹੈ ਇਹ ਕਿਤਾਬ ਸਭ ਤੋਂ ਵਧੀਆ ਕਿਤਾਬ ਹੈ ਜੋ ਕਿ ਸਾਨੂੰ ਵਿਗਿਆਨ ਨਾਲ ਜੋੜਦੀ ਹੈ ਅਤੇ ਸੰਸਾਰ ਵਿੱਚ ਹੋ ਰਹੀਆਂ ਚੀਜ਼ਾਂ ਨੂੰ ਵਿਗਿਆਨ ਦੇ ਢੰਗ ਨਾਲ ਦਰਸਾਉਂਦੀ ਹੈ ਧੰਨਵਾਦ